ਪ੍ਰਾਣਾਯਾਮ ਇੱਕ ਬਹੁਤ ਹੀ ਵਧੀਆ ਯੋਗਾ ਪ੍ਰਕਿਰਿਆ ਹੈ ਇਹ ਸਾਨੂੰ ਅੰਦਰੂਨੀ ਬਿਮਾਰੀਆਂ ਤੋਂ ਬਚਾਉਂਦਾ ਹੈ ਸਾਨੂੰ ਸਾਰਿਆਂ ਨੂੰ ਪ੍ਰਾਣਾਯਾਮ ਜ਼ਰੂਰ ਕਰਨਾ ਚਾਹੀਦਾ ਹੈ